ਹੈਲੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹੋਰ ਕੀ ਹਾਲ ਚਾਲ ਠੀਕ ਹੋ ਜੀ ਬਹੁਤ ਵਧੀਆ ਪਾਣੀ ਦਾ ਕਾਕਾ ਇਹ ਗੱਲ ਆ ਵੀ ਆਪਾਂ ਅਸੀਂ ਵੀ ਚੈੱਕ ਕਰਵਾਇਆ ਤੁਸੀਂ ਚੈੱਕ ਕਰਵਾਇਆ ਪਾਣੀ ਪਾਣੀ ਦੇ ਵਿੱਚ ਕੌਲੀਫੋਰਮ ਵਾਇਰਸ ਵਗੈਰਾ ਹੁਣ ਆ ਜਾਂਦਾ ਸੀਜਨਲ ਹੈ ਨਾ ਅਤੇ ਬਾਕੀ ਜਿਹੜਾ ਪਾਣੀ ਆਪਣੀ ਜਿਹੜੀਆਂ ਫੈਕਟਰੀਆਂ ਨੇ ਇੰਡਸਟਰੀ ਨੇ ਉਦਯੋਗ ਜਿਹੜੇ ਹੈਗੇ ਨੇ ਇਹ ਥੱਲੇ ਆਪਣੇ ਧਰਤੀ ਹੇਠਲੇ ਪਾਣੀ ਦੇ ਵਿੱਚ ਦੇ ਵਿੱਚ ਜਿਹੜਾ ਪਾਣੀ ਉਹ ਮਲਾਈ ਜਾਂਦੇ ਆ ਜਿਹਦੇ ਕਰਕੇ ਹਾਂ ਜਿਹਦੇ ਕਰਕੇ ਪਾਣੀ ਇਹ ਪਾਣੀ ਇਹ ਬਹੁਤ ਗੰਧਲਾ ਹੋ ਗਿਆ ਹੈ ਇਹਦਾ ਕਲਰ ਵੀ ਚੇਂਜ ਹੋਇਆ ਹੋਇਆ ਪਾਣੀ ਦਾ ਤੁਸੀਂ ਦੇਖਿਆ ਕਦੇ ਨੋਟਿਸ ਕੀਤਾ ਹਾਂ ਹਾਂ ਅਤੇ ਇਹ ਆਪਣੇ ਆਹ ਲੁਧਿਆਣੇ 'ਚ ਖਾਸ ਕਰਕੇ ਪ੍ਰੋਬਲਮ ਆ ਗਈ ਆ ਅਤੇ ਲੁਧਿਆਣੇ ਦੇ ਵਿੱਚ ਤੁਸੀਂ ਦੇਖਿਆ ਹੋਊ ਵੀ ਪਾਣੀ ਦਾ ਰੰਗ ਅਤੇ ਇਹਦਾ ਪਾਣੀ ਦਾ ਟੇਸਟ ਵੀ ਬਹੁਤ ਬਦਲ ਗਿਆ ਹੈ ਇਹਦੇ ਨਾਲ ਡਾਕਟਰ ਵੀ ਦੱਸਦੇ ਨੇ ਹੁਣ ਕਾਲਾ ਪੀਲੀਆ ਕੈਂਸਰ ਵਰਗੀਆਂ ਬਿਮਾਰੀਆਂ ਆਮ ਹੋ ਚੱਲੀਆਂ ਇਸ ਏਰੀਏ 'ਚ ਇਸ ਖੇਤਰ ਦੇ ਵਿੱਚ ਨਾ ਇਹਦੇ ਕਰਕੇ ਹੁੰਦੀਆਂ ਨੇ ਅਤੇ ਤੁਸੀਂ ਫਿਲਟਰ ਵਗੈਰਾ ਲਵਾਓ ਅਤੇ ਇਹ ਇਹ ਬਹੁਤ ਜ਼ਰੂਰੀ ਆ ਹਾਂ ਹਾਂ ਹਾਂ ਇਹ ਇਹ ਪਾਣੀ ਦੇ ਪਾਣੀ ਕਰਕੇ ਹੀ ਆ ਜ਼ਿਆਦਾਤਰ ਤਾਂ ਹੈ ਨਾ ਅਤੇ ਤਾਂ ਹੀ ਉਹ ਆ ਹੁਣ ਜਿਹੜੇ ਜਿਹੜਾ ਆਹ ਚੱਲਦੇ ਨੇ ਮੋਰਚੇ ਚਲਦੇ ਨੇ ਬੁੱਢੇ ਨਾਲੇ 'ਤੇ ਉਹ ਵੀ ਇਸੇ ਕਰਕੇ ਹੀ ਨੇ ਉਹ ਵੀ ਜਿਹੜਾ ਫੈਕਟਰੀਆਂ ਦਾ ਪਾਣੀ ਆ ਉਹ ਭਾਈ ਇਹਦੇ 'ਚ ਨਾ ਪਾਓ ਬੁੱਢੇ ਨਾਲੇ 'ਚ ਜਾਂ ਉਹਨੂੰ ਉਹਦਾ ਪ੍ਰੋਪਰ ਜਿਹੜਾ ਟਰੀਟਮੈਂਟ ਕਰਕੇ ਉਹਨੂੰ ਸਾਫ਼ ਕਰਕੇ ਪਾਇਆ ਜਾਵੇ ਉਹਦੀ ਉਹਦੀ ਪੁਣ ਛਾਣ ਕੀਤੀ ਜਾਵੇ ਸੋ ਇਹ ਇੱਕ ਇਹ ਤਾਂ ਵੀ ਹੁਣ ਆਪਾਂ ਇਸ ਲੈਵਲ 'ਤੇ ਆਪਾਂ ਨਹੀਂ ਗੱਲ ਕਰ ਸਕਦੇ ਕਿਉਂਕਿ ਆਪਣੇ ਕੋਲ ਨਾ ਤਾਂ ਅਥੋਰਿਟੀ ਆ ਅਤੇ ਨਾ ਆਪਣਾ ਇਹ ਫੀਲਡ ਆ ਨਾ ਹੀ ਆਪਣਾ ਇਹ ਪਰ ਮੈਨੂੰ ਇਹ ਲੱਗਦਾ ਵੀ ਕਿਤੇ ਨਾ ਕਿਤੇ ਜਿਹੜੀਆਂ ਇੰਡਸਟਰੀਆਂ ਨੇ ਜਾਂ ਫੈਕਟਰੀਆਂ ਨੇ ਸਾਨੂੰ ਸਾਰਿਆਂ ਨੂੰ ਇਹ ਸਮਝਣਾ ਚਾਹੀਦਾ ਵਾਤਾਵਰਨ ਜਿਹੜਾ ਇਹਨੂੰ ਖ਼ਰਾਬ ਨਾ ਹੋਣ ਦੇਈਏ ਇਹਨੂੰ ਦੂਸ਼ਿਤ ਨਾ ਹੋਣ ਦੇਈਏ ਇਹਨੂੰ ਕਿਵੇਂ ਨਾ ਕਿਵੇਂ ਬਚਾ ਲਈਏ ਹੈ ਨਾ ਜੇ ਪਾਣੀ ਇਹ ਖ਼ਰਾਬ ਹੋ ਗਿਆ ਅਤੇ ਫਿਰ ਬਾਅਦ ਵਿੱਚ ਜਿਹੜੀਆਂ ਆਉਣ ਵਾਲੀਆਂ ਪੀੜ੍ਹੀਆਂ ਨੇ ਉਹਨਾਂ ਨੂੰ ਪਛਤਾਉਣਾ ਪਵੇਗਾ ਨਤੀਜੇ ਤਾਂ ਆਉਣੇ ਸ਼ੁਰੂ ਹੋ ਗਏ ਨੇ ਹੈ ਨਾ ਅਤੇ ਤੁਸੀਂ ਦੇਖੋ ਕਈ ਪਿੰਡਾਂ ਦੇ ਪਿੰਡ ਖਾਲੀ ਹੋ ਰਹੇ ਨੇ ਜਿੱਥੇ ਧਰਤੀ ਹੇਠਲਾ ਪਾਣੀ ਖਤਮ ਹੋ ਗਿਆ ਉਥੋਂ ਥੱਲਿਓਂ ਪਾਣੀ ਨਹੀਂ ਮਿਲ ਰਿਹਾ ਸੋ ਇਸ ਕਰਕੇ ਆ ਤੁਸੀਂ ਇਹ ਦੇਰ ਨਾ ਲਾਓ ਇਹ ਤਾਂ ਤੁਸੀਂ ਆਪਦਾ ਪਾਣੀ ਦਾ ਸੈਂਪਲ ਚੈੱਕ ਕਰਵਾਓ ਉਹਦੇ 'ਚ ਦੇਖੋ ਕੀ ਕੀ ਆ ਰਿਹਾ ਕੁਛ ਦੱਸਦੇ ਹੁੰਦੇ ਆ ਬਈ ਇਹ ਤੁਸੀਂ ਯੂਨੀਵਰਸਿਟੀ ਜਾਓ ਪੰਜਾਬੀ ਐਗਰੀਕਲਚਰ ਯੂਨੀਵਰਸਿਟੀ ਆ ਉਥੇ ਚੈੱਕ ਟੀ ਡੀ ਐਸ ਚੈੱਕ ਕਰਦੇ ਆ ਅਤੇ ਬਾਕੀ ਉਹਦੇ 'ਚ ਬੈਕਟੀਰੀਆ ਵਗੈਰਾ ਕੋਈ ਆ ਰਿਹਾ ਪਾਣੀ ਦੇ ਵਿੱਚ ਕੰਟੈਮੀਨੇਟ ਕੀ ਕੀ ਆ ਰਹੇ ਨੇ ਕਿਹੜੀਆਂ ਕਿਹੜੀਆਂ ਚੀਜ਼ਾਂ ਇਹਦੇ 'ਚ ਆ ਰਹੀਆਂ ਨੇ ਇਹਦਾ ਭਾਰਾਪਣ ਸਾਰਾ ਕੁਝ ਚੈੱਕ ਹੋ ਜਾਂਦਾ ਪਾਣੀ ਦਾ ਹਾਂਜੀ ਹਾਂਜੀ ਪਾਣੀ ਨੂੰ ਤੁਸੀਂ ਜਿਵੇਂ ਅੱਜ ਸੈਂਪਲ ਦੇ ਆਓਗੇ ਤੁਹਾਨੂੰ ਦੂਜੀ ਜਾਂ ਤੀਜੇ ਦਿਨ ਉਹਦੀ ਸੈਂਪਲ ਦੀ ਰਿਪੋਰਟ ਮਿਲ ਜਾਣੀ ਆ ਫਿਰ ਉਹਦੇ ਹਿਸਾਬ ਦੇ ਪੈਸੇ ਤਾਂ ਕੋਈ ਜਿਆਦਾ ਨਹੀਂ ਲੱਗਦੇ ਸੌ ਕੁ ਰੁਪਏ ਇੱਕ ਸੈਂਪਲ ਦਾ ਲੱਗਦਾ ਅਤੇ ਜਿਹੜਾ ਆਪਾਂ ਫਸਲਵਾੜੀ ਨੂੰ ਵੀ ਪਾਣੀ ਦਿੰਦੇ ਹਾਂ ਨਾ ਖੇਤਾਂ ਦੇ ਵਿੱਚ ਵੀ ਪਾਣੀ ਉਹ ਵੀ ਚੈੱਕ ਕਰਾ ਲੈਣਾ ਚਾਹੀਦਾ ਉਹ ਵੀ ਪਾਣੀ ਵਧੀਆ ਚਾਹੀਦਾ ਤਾਂ ਵਧੀਆ ਜਿਹੜੀ ਕੁਆਲਿਟੀ ਦੇ ਜਿਹੜੀ ਫਸਲ ਆ ਆਪਣੀ ਵਧੀਆ ਗੁਣਵੱਤਾ ਵਾਲੀ ਫਸਲ ਹੋਵੇਗੀ ਹਾਂਜੀ ਹਾਂਜੀ ਓਕੇ ਠੀਕ ਹੈ ਠੀਕ ਆ ਜੀ ਠੀਕ ਆ ਠੀਕ ਆ ਪੁੱਤਰੋ